ਮੈਂ ਅਕਸਰ ਆਪਣੇ ਪਰਿਵਾਰ ਦੇ ਨਾਲ ਟੂਰ 'ਤੇ ਜਾਂਦੀ ਰਹਿੰਦੀ ਹਾਂ ਮੇਰਾ ਪਸੰਦੀਦਾ ਸ਼ਹਿਰ ਅੰਮ੍ਰਿਤਸਰ ਹੈ ਅੰਮ੍ਰਿਤਸਰ ਪੰਜਾਬ ਦਾ ਪ੍ਰਮੁੱਖ ਵੱਡਾ ਸ਼ਹਿਰ ਹੈ ਜੋ ਕਿ ਗੁਰੂ ਦੀ ਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਦੀ ਨਗਰੀ ਅੰਮ੍ਰਿਤਸਰ ਆਪਣੇ ਵਿਰਾ ਵਿਰਾਸਤ ਅਤੇ ਇਤਿਹਾਸਿਕ ਸਥਾਨਾਂ ਕਰਕੇ ਜਾਣਿਆ ਜਾਂਦਾ ਹੈ ਇਹ ਚਾਹੇ ਜਿੱਥੇ ਗੁਰੂਆਂ ਦਾ ਇਤਿਹਾਸ ਸਾਂਭੀ ਬੈਠਾ ਹੈ ਨਾਲ ਹੀ ਇਹ ਸ਼ਹਿਰ ਵੱਖੋ ਵੱਖਰੇ ਧਾਰਮਿਕ ਅਤੇ ਘੁੰਮਣ ਫਿਰਨ ਸਥਾਨਾਂ ਕਰਕੇ ਵੀ ਜਾਣਿਆ ਜਾਂਦਾ ਹੈ ਇਸ ਸ਼ਹਿਰ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਟੂਰਿਸਟ ਘੁੰਮਣ ਫਿਰਨ ਆਉਂਦੇ ਹਨ ਵਿਸ਼ਵ ਪ੍ਰਸਿੱਧ ਸ਼੍ਰੀ ਸੱਚਖੰਡ ਦਰਬਾਰ ਸਾਹਿਬ ਜਲ੍ਹਿਆਂਵਾਲਾ ਬਾਗ ਬਾਘਾ ਬੋਡਰ ਅਤੇ ਦੇਵੀ ਤਲਾਬ ਮੰਦਰ ਵਰਗੇ ਕਈ ਮਸ਼ਹੂਰ ਮੰਦਿਰ ਹਨ ਹਰਿਮੰਦਰ ਸਾਹਿਬ ਜੋ ਕਿ ਸਿੱਖਾਂ ਦਾ ਧਾਰਮਿਕ ਸਥਾਨ ਹੈ ਈ ਜੋ ਕਿ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਹਰਿਮੰਦਰ ਸਾਹਿਬ ਆਪਣੀ ਸੋਨੇ ਦੀ ਇਮਾਰਤ ਕਰਕੇ ਪ੍ਰਸਿੱਧ ਹੈ ਇਹ ਸਿੱਖਾਂ ਦਾ ਸਭ ਤੋਂ ਵੱਡਾ ਪਵਿੱਤਰ ਤੀਰਥ ਅਸਥਾਨ ਹੈ ਜੋ ਕਿ ਦੋ ਮੰਜ਼ਿਲ ਇਮਾਰਤ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਿਮੰਦਰ ਸਾਹਿਬ ਦਾ ਸਭ ਤੋਂ ਪਹਿਲਾਂ ਹਿੱਸਾ ਚਾਰ ਸੌ ਕਿਲੋ ਸੋਨੇ ਦੀ ਪੱਤਿਆਂ ਨਾਲ ਬਣਾਇਆ ਸੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਮੰਦਿਰ ਹਨ ਜਿਵੇਂ ਕਿ ਦੁ ਦੁਰਗਾ ਮਾਤਾ ਮੰਦਿਰ ਜੋ ਕਿ ਹਿੰਦੂਆਂ ਦਾ ਇੱਕ ਧਾਰਮਿਕ ਪਵਿੱਤਰ ਸਥਾਨ ਹੈ ਹਮੰ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਘੁੰਮਣ ਨੂੰ ਬਥੇਰੇ ਸਥਾਨ ਹਨ ਜਿਵੇਂ ਕਿ ਜਲ੍ਹਿਆਂਵਾਲਾ ਬਾਗ ਜੋ ਕੀ ਅੰਮ੍ਰਿਤਸਰ ਦੀ ਕੰਧ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਬਾਘਾ ਬੋਡਰ ਜੋ ਕਿ ਭਾਰਤ ਪਾਕਿਸਤਾਨ ਦਾ ਇੰਟਰਨੈਸ਼ਨਲ ਬੋਡਰ ਹੈ ਮੈਨੂੰ ਅੰਮ੍ਰਿਤਸਰ ਜਾਣਾ ਬਹੁਤ ਪਸੰਦ ਹੈ ਅਤੇ ਮੈਂ ਫਿਰ ਤੋਂ ਵੀ ਅੰਮ੍ਰਿਤਸਰ ਜਾਣਾ ਪਸੰਦ ਕਰਦੀ ਹਾਂ